ਅੱਜ ਭਾਰਤ ਦੇ ਸਾਹਮਣੇ ਵਾਤਾਵਰਨ ਸਬੰਧੀ ਸਭ ਤੋਂ ਵੱਡੇ ਮੁੱਦੇ ਹਨ ਜਿਵੇਂ ਕਿ ਗਲੋਬਲ ਵਾਰਮਿੰਗ ਵੱਧ ਰਿਹਾ ਪੋਲਿਊਸ਼ਨ ਗੱਡੀਆਂ ਵੱਧ ਰਹੀਆਂ ਨੇ ਅੱਜ ਕੱਲ੍ਹ ਹਰ ਘਰ ਵਿੱਚ ਵਹੀਕਲ ਆ ਸਾਰੇ ਆਪਣਾ ਵਹੀਕਲ ਪ੍ਰੈਫਰ ਕਰਦੇ ਨੇ ਜਿਹਦੇ ਨਾਲ ਕਿ ਬਹੁਤ ਸਾਰਾ ਵਾਤਾਵਰਨ ਪਲਿਊਟ ਹੋ ਰਿਹਾ ਕਿ ਆਪਣੇ ਵਸਤੇ ਹੀ ਬਿਮਾਰੀਆਂ ਵੱਧ ਰਹੀਆਂ ਨੇ ਕਿੰਨੀਆਂ ਸਾਰੀਆਂ ਪਰੇਸ਼ਾਨੀਆਂ ਹਾਰਟ ਦੀਆਂ ਪ੍ਰੋਬਲਮਸ ਕਿੰਨੀ ਸਾਰੀ ਅਸਥਮਾ ਵਾਂਗੂ ਵਰਗੀਆਂ ਤਕਲੀਫਾਂ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਜਿਵੇਂ ਕਿ ਪਿਛਲੇ ਕੁਛ ਸਾਲਾਂ ਤੋਂ ਆਲਾ ਦੁਆਲਾ ਕਿੰਨਾ ਇਫੈਕਟ ਹੋ ਰਿਹਾ ਇਹਨਾਂ ਚੀਜ਼ਾਂ ਨਾਲ ਨਦੀਆਂ 'ਚ ਲੋਕੀਂ ਇੰਡਸਟਰੀਜ਼ ਦਾ ਵੇਸਟ ਸੁੱਟੀ ਜਾ ਰਹੇ ਨੇ ਫੈਕਟਰੀਆਂ ਦਾ ਵੇਸਟ ਸੁੱਟ ਰਹੇ ਨੇ ਜਿਨ੍ਹਾਂ ਨਾਲ ਜੀਵ ਜੰਤੂਆਂ ਨੂੰ ਕਿੰਨੀ ਮੁਸ਼ਕਿਲ ਹੁੰਦੀ ਹੈ ਉਹ ਜਦੋਂ ਨਦੀਆਂ 'ਚੋਂ ਪਾਣੀ ਪੀਂਦੇ ਨੇ ਅਫੈਕਟ ਹੁੰਦੇ ਨੇ ਬਿਮਾਰ ਹੁੰਦੇ ਨੇ ਮਰਦੇ ਨੇ ਸਮੁੰਦਰਾਂ ਦਾ ਅ ਪਾਣੀ ਖ਼ਰਾਬ ਹੋ ਰਿਹਾ ਹੈ ਖੇਤ ਲੋਕੀਂ ਆਪਣੇ ਛੱਡ ਕੇ ਉਹਨਾਂ 'ਚ ਕਲੋਨੀਆਂ ਕੱਟਦੇ ਜਾ ਰਹੇ ਨੇ ਆਪਣੀ ਖੇਤੀਬਾੜੀ ਛੱਡ ਕੇ ਲੋਕ ਇੰਡਸਟਰੀਜ਼ ਵੱਲ ਜ਼ਿਆਦਾ ਵੱਧ ਰਹੇ ਨੇ ਜਿਹਦੇ ਨਾਲ ਖੇਤੀਬਾੜੀ ਬਹੁਤ ਪਿੱਛੇ ਰਹਿੰਦੀ ਜਾ ਰਹੀ ਹੈ ਅਤੇ ਮਿੱਟੀ ਵੀ ਉਪਜਾਊ ਨਹੀਂ ਰਹਿ ਰਹੀ ਲੋਕੀਂ ਉਹਦਾ ਵੱਧ ਤੋਂ ਵੱਧ ਇੰਡਸਟਰੀਜ਼ ਵੱਲ ਧਿਆਨ ਕਰ ਰਹੇ ਨੇ ਆਪਣਾ ਅਤੇ ਪੈਸੇ ਕਮਾਉਣ ਦੀ ਦੋੜ ਵਿੱਚ ਲੱਗੇ ਹੋਏ ਨੇ ਅਤੇ ਸਾਲ ਦੌਰਾਨ ਇਸੇ ਕਰਕੇ ਆਪਾਂ ਨੂੰ ਮ ਮੌਸਮ 'ਚ ਵੀ ਕਿੰਨੀਆਂ ਪਰੇਸ਼ਾਨੀਆਂ ਵੇਖਣ ਨੂੰ ਮਿਲਦੀਆਂ ਨੇ ਜਿਵੇਂ ਪਹਿਲੇ ਵਾਂਗੂ ਕਦੀ ਗਰਮੀ ਨਹੀਂ ਪੈਂਦੀ ਉਨੀ ਬਰਸਾਤਾਂ ਬਿਨ ਮੌਸਮ ਬਰਸਾਤ ਜਿਵੇਂ ਪਲਿਊਟਿਡ ਰੇਨਸ ਹੋ ਰਹੀਆਂ ਨੇ ਜਿਸ ਦੇ ਨਾਲ ਕਿ ਸਾਨੂੰ ਬਹੁਤ ਇਫੈਕਟ ਕਰ ਰਹੀਆਂ ਨੇ ਇਨਵਾਇਰਮੈਂਟ ਨੂੰ ਵੀ ਅਤੇ